ਹੈਲੋ ਸਤਿ ਸ਼੍ਰੀ ਅਕਾਲ ਸਰ ਮੈਂ ਮੀਨਾਕਸ਼ੀ ਪਠਾਨਕੋਟ ਤੋਂ ਬੋਲ ਰਹੀ ਹਾਂ ਸਾਨੂੰ ਕਈ ਸ ਕਈ ਸਥਾਨਾਂ 'ਤੇ ਯਾਤਰਾ ਕਰਨੀ ਚਾਹੀਦੀ ਹੈ ਜਿਵੇਂ ਕਿ ਅੰਬਰਸਰ ਅੰਮ੍ਰਿਤਸਰ ਜਿਸ ਵਿ ਜਿ ਜਿੱਥੇ ਕਈ ਸਥਾਨ ਘੁੰਮਣ ਯਾਤਰਾ ਕਰਨ ਲਈ ਵਧੀਆ ਹਨ ਜਿਵੇਂ ਗੋਲਡਨ ਟੈਂਪਲ ਗੋਲਡਨ ਟੈਂਪਲ ਜਾ ਕੇ ਸਾਨੂੰ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਅਤੇ ਕਈ ਹੋਰ ਤੀਰਥ ਸਥਾਨ ਹਨ ਜਿਵੇਂ ਅਟਾਰੀ ਬਾਰਡਰ ਜਲ੍ਹਿਆਂਵਾਲਾ ਬਾਗ ਜਿਸ ਵਿੱਚ ਕਈ ਤਰ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਵਧੀਆ ਕਿਸਮ ਇਹ ਚੀਜ਼ਾਂ ਘੁੰਮ ਵੇਖਣ ਨੂੰ ਮਿਲਦੀਆਂ ਹਨ ਅਤੇ ਘੁੰਮਣ ਨੂੰ ਜਿਸ ਕਰਕੇ ਸਾਨੂੰ ਕਈ ਚੀਜ਼ਾਂ ਦੀ ਜਾਣਕਾਰੀ ਹੁੰਦੀ ਹੈ ਜਿੱਥੇ ਕਈ ਸ਼ਹੀਦਾਂ ਨੇ ਦੇਸ਼ ਲਈ ਕੁਰਬਾਨੀ ਦਿੱਤੀ ਸੀ ਅਤੇ ਇਸ ਤੋਂ ਇਲਾਵਾ ਹੋਰ ਵੀ ਕਈ ਸਥਾਨ ਹਨ ਜਿਵੇਂ ਵੈਸ਼ਨੋ ਮਾਤਾ ਕਟਰਾ ਵਿੱਚ ਸਥਿਤ ਹੈ ਜੰਮੂ ਕਟਰਾ ਵਿੱਚ ਸਥਿਤ ਹੈ